ਭਾਰਤੀ ਮੀਡੀਆ ਨੂੰ ਚੰਗਾ ਵੀ ਨਹੀਂ ਕਹਿ ਸਕਦੇ ਅਤੇ ਮਾੜਾ ਵੀ ਨਹੀਂ ਕਹਿ ਸਕਦੇ ਇੱਥੇ ਪ੍ਰਾਈਵੇਟ ਚੈਨਲ ਆਪਣੀਆਂ ਟੀ ਆਰ ਪੀ ਵਧਾਉਣ ਲਈ ਖਬਰਾਂ ਨੂੰ ਵਧਾ ਚੜਾ ਕੇ ਦੱਸਦੇ ਹਨ ਕੁਝ ਚੈਨਲ ਜੋ ਸੱਚਾਈ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਹਨ ਪੰਜਾਬੀ ਟ੍ਰਿਬਿਊਨ ਜਗਬਾਣੀ ਹਿੰਦੁਸਤਾਨ ਟਾਈਮਸ ਇੰਡੀਅਨ ਐਕਸਪ੍ਰੈਸ ਆਦਿ ਮਸ਼ਹੂਰ ਅਖਬਾਰ ਹਨ ਚੈਨਲਾਂ ਵਿੱਚ ਐੱਨ ਡੀ ਟੀ ਵੀ ਪੀ ਟੀ ਸੀ ਨਿਊਜ਼ ਦੇਖਣਾ ਲੋਕ ਜ਼ਿਆਦਾ ਪਸੰਦ ਕਰਦੇ ਹਨ